ਜਿਵੇਂ ਕਿ ਨਾ ਮੈਨੂੰ ਕਾਫ਼ੀ ਸ਼ੌਂਕ ਹੁੰਦੇ ਸੀਗੇ ਅਤੇ ਫੋਟੋਗ੍ਰਾਫੀ ਦਾ ਸ਼ੌਂਕ ਮੈਨੂੰ ਜਿਵੇਂ ਛੋਟੇ ਹੁੰਦਿਆਂ ਤੋਂ ਕਾਫ਼ੀ ਹੁੰਦਾ ਸੀਗਾ ਨਵੀਆਂ ਨਵੀਆਂ ਜਗ੍ਹਾ 'ਤੇ ਜਾਣਾ ਨਵੇਂ ਨਵੀਆਂ ਚੀਜ਼ਾਂ ਦੇਖਣੀਆਂ ਅਤੇ ਮੈਂ ਆਪਣੇ ਫੋਨ ਵਿੱਚ ਉਹਨਾਂ ਦੀਆਂ ਫੋਟੋਆਂ ਖਿੱਚਦਾ ਰਹਿਣਾ ਅਤੇ ਫਿਰ ਮੈਂ ਉਹ ਫੋਟੋਆਂ ਖਿੱਚ ਕੇ ਕਾਫ਼ੀ ਵਧੀਆ ਫੋਟੋ ਖਿੱਚ ਹੋ ਜਾਣੀਆਂ ਅਤੇ ਮੈਂ ਉਹ ਘਰ ਆਪਣੇ ਫੋਟੋਆਂ ਲਗਾ ਦੇਣੀਆਂ ਉਹ ਫਿਰ ਮੇਰੇ ਯਾਰ ਦੋਸਤਾਂ ਨੇ ਵੇ ਦੇਖੀਆਂ ਉਹ ਵਾਲੀਆਂ ਫੋਟੋਆਂ ਅਤੇ ਉਹ ਕਹਿੰਦੇ ਕਿ ਤੂੰ ਇਹਨੂੰ ਇਹ ਆਪਣਾ ਪ੍ਰੋਫੈਸ਼ਨ ਕਾਹਤੋਂ ਨਹੀਂ ਚੁਣਦਾ ਹੈਗਾ ਅਤੇ ਇਹ ਫੋਟੋਗ੍ਰਾਫੀ ਲਾਈਨ ਵਿੱਚ ਤੂੰ ਅੱਗੇ ਜਾ ਅਤੇ ਅੱਗੇ ਜਾ ਕੇ ਇਹਦੇ ਦੇ ਵਿੱਚ ਹੀ ਤੂੰ ਚਾਰ ਪੈਸੇ ਵੀ ਕਮਾ ਸਕਦਾ ਹੈ ਤੂੰ ਇਹਨੂੰ ਆਪਣਾ ਇੱਕ ਮੇਨ ਬਿਜ਼ਨਸ ਬਣਾ ਲੈ ਅਤੇ ਇਹ ਤੋਂ ਤੂੰ ਆਪਣੇ ਸ਼ੌਂਕ ਵੀ ਤੇਰਾ ਪੂਰਾ ਹੋਈ ਜਾਣਾ ਨਾਲ ਨਾਲ ਤੂੰ ਆਪਣੇ ਪੈਸੇ ਵੀ ਕਮਾਊਂਗਾ ਅਤੇ ਫਿਰ ਮੈਂ ਮੇਰੇ ਦਿਮਾਗ ਨੂੰ ਵੀ ਕਾਫ਼ੀ ਇਹ ਚੀਜ਼ ਵਧੀਆ ਲੱਗੀ ਕਿ ਇਹ ਕੰਮ ਤਾਂ ਵਧੀਆ ਹੈ ਕਿ ਮੇਰਾ ਨਾਲ ਨਾਲ ਸ਼ੌਂਕ ਵੀ ਪੂਰਾ ਹੋ ਰਿਹਾ ਅਤੇ ਮੈਨੂੰ ਨਾਲ ਨਾਲ ਪੈਸੇ ਵੀ ਬਣ ਰਹੇ ਆ ਅਤੇ ਫਿਰ ਮੈਂ ਮੈਨੂੰ ਇਹ ਪ੍ਰੋਫੈਸ਼ਨ ਵਧੀਆ ਲੱਗਿਆ ਅਤੇ ਮੈਂ ਸਟਾਰਟ ਕਰ ਦਿੱਤਾ ਫੋਟੋਗ੍ਰਾਫੀ ਕਰਨੀ ਅਤੇ ਹੁਣ ਮੈਂ ਜਿਵੇਂ ਅਤੇ ਹੁਣ ਮੈਂ ਜਿਵੇਂ ਵਿਆਹਾਂ ਸ਼ਾਦੀਆਂ ਵਿੱਚ ਵੀ ਫੋਟੋਆਂ ਖਿੱਚਦਾ ਰਹਿੰਦਾ ਅਤੇ ਪ੍ਰੀ ਵੈਡਿੰਗਾਂ ਅਤੇ ਹੁਣ ਮੈਂ ਸਾਰੇ ਆਪਣੇ ਜਿਹੜੇ ਮੇਰੇ ਸਮਾਨ ਵਰਤੋਂ 'ਚ ਆਂਉਦਾ ਫੋਟੋਗ੍ਰਾਫੀ ਲਈ ਮੇਰਾ ਕੈਮਰਾ ਮੇਰੇ ਡਰੋਨ ਮੈਂ ਸਾਰਾ ਕੁਛ ਲੈ ਲਿਆ ਅਤੇ ਉਹਨਾਂ ਨਾਲ ਮੈਂ ਆਪਣੀ ਨਾਲ ਨਾਲ ਮੇਰਾ ਸ਼ੌਂਕ ਵੀ ਪੂਰਾ ਹੋਈ ਜਾਂਦਾ ਅਤੇ ਨਾਲ ਨਾਲ ਮੈਂ ਚਾਰ ਪੈਸੇ ਵੀ ਕਮਾਈ ਜਾਂਦਾ ਅਤੇ ਇਹ ਇਹ ਸ਼ੌਂਕ ਮੈਨੂੰ ਮਤਲਬ ਸ਼ੁਰੂ ਤੋਂ ਹੀ ਸੀਗਾ ਅਤੇ ਦ ਇਹ ਉਮਰ ਦੇ ਹਿਸਾਬ ਨਾਲ ਫਿਰ ਇਹ ਸ਼ੌਂਕ ਵਧਦਾ ਗਿਆ ਅਤੇ ਇਹਨੇ ਫੇ ਮੇਰਾ ਪ੍ਰੋਫੈਸ਼ਨ ਵੀ ਇਹ ਹੀ ਬਣ ਚੁੱਕਿਆ ਸੀਗਾ